ਜਿਵੇਂ ਕੀ ਮੈਨੂੰ ਫੋਟੋਗ੍ਰਾਫੀ ਦਾ ਸ਼ੌਂਕ ਸੀ ਕਾਫੀ ਟਾਈਮ ਤੋਂ ਹੈ ਮੈਂ ਜਦ ਸਕੂਲ 'ਚ ਬਾਰਵੀਂ ਜਮਾਤ 'ਚ ਹੁੰਦਾ ਸੀਗਾ ਜੀ ਜਦ ਤੋਂ ਹੀ ਮੈਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ ਮੈਂ ਜਿਵੇਂ ਜੀ ਇੰਟਰਨੈਟ 'ਤੇ ਬਹੁਤ ਹੀ ਫੇਮਸ ਫੋਟੋਗ੍ਰਾਫਰ ਹੈ ਜੀ ਸੈਮ ਕਲਰ ਉਹਨਾਂ ਦੀਆ ਫੋਟੋਆਂ ਦੇਖੀਆਂ ਸੀਗੀਆਂ ਜਿੱਥੋਂ ਮੈਨੂੰ ਆਹ ਸ਼ੌਂਕ ਮੇਰਾ ਜਾਗਿਆ ਉਹਤੋਂ ਬਾਅਦ ਮੈਂ ਹੌਲੀ ਹੌਲੀ ਕਰਕੇ ਕੈਮਰਾ ਜਿਹੜਾ ਹੈਗਾ ਉਹ ਪਰਚੇਜ਼ ਕੀਤਾ ਖਰੀਦਿਆ ਅਤੇ ਮੈਂ ਬਹੁਤ ਅਲੱਗ ਅਲੱਗ ਤਰੀਕੇ ਦੀਆਂ ਤਸਵੀਰਾਂ ਖਿਚਦਾ ਹਾਂ ਜਿਸ ਵਿੱਚ ਵਿਆਹ ਦੀਆਂ ਫੋਟੋਆਂ ਆ ਆ ਜਾਂਦੀਆਂ ਹਨ ਜਾਂ ਪ੍ਰੀ ਵੈਡਿੰਗ ਹੋ ਜਾਂਦੀ ਹੈ ਜੀ ਉਹ ਮਤਲਬ ਜਿਵੇਂ ਕੋਈ ਉਹਨੂੰ ਅਸੀਂ ਫਿਲਮ ਵਾਂਗ ਬਣਾ ਦਿੰਦੇ ਹਾਂ ਜਿਹੜੀ ਪ੍ਰੀ ਵੈਡਿੰਗ ਹੁੰਦੀ ਹੈ ਜੀ ਅਤੇ ਬਾਕੀ ਹੋਰ ਵੀ ਬਹੁਤ ਕੰਪਨੀਆਂ ਵਾਸਤੇ ਮੈਂ ਫੋਟੋਆਂ ਖਿੱਚਦਾ ਹਾਂ ਜਿਹਦੇ ਵਿੱਚ ਰੀਅਲ ਸਟੇਟ ਆ ਜਾਂਦੀ ਹੈ ਜਾਂ ਹੋਰ ਜਿਵੇਂ ਕੋਈ ਪ੍ਰੋਡਕਟ ਸ਼ੂਟ ਹੁੰਦਾ ਹੈ ਜੀ ਕਿਸੇ ਵੀ ਪ੍ਰੋਡਕਟ ਦਾ ਉਹ ਉਹ ਕੈਪਚਰ ਕਰਦੇ ਹਾਂ ਉਹਦੀਆਂ ਅਲੱਗ ਤਰ੍ਹਾਂ ਨਾਲ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ ਜੋ ਕਿ ਬਹੁਤ ਜ਼ੂਮ ਲੈਂਸ ਤੋਂ ਖਿੰਚਦੇ ਹਾਂ ਅਤੇ ਉਹਨਾਂ ਨੂੰ ਫਿਰ ਉਹਨਾਂ ਦੀਆਂ ਐਡਾਂ ਬਣਾ ਕੇ ਅਸੀਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਾਂ